ਮੈਂ ਪੂਰੇ ਦਿਨ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਮਾਈਕਰੋਵੇਵ ਮਿਕਸੀ ਵਗੈਰਾ ਹੈ ਨਾ ਚਾਕੂ ਹੈ ਨਾ ਕਾਫੀ ਚੀਜ਼ਾਂ ਜਿਹੜੀਆਂ ਨੇ ਯੂਸ ਕਰਦੀ ਹਾਂ ਅਤੇ ਇਹ ਨਵੀਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਹਨ ਜੂਸਰ ਵਗੈਰਾ ਅਤੇ ਜੂਸ ਵਗੈਰਾ ਵੀ ਘਰ ਕੱਢ ਕੇ ਅਸੀਂ ਦਿਨ ਰਾਤ ਪੀ ਸਕਦੇ ਹਾਂ ਇਹ ਨਵੇਂ ਉਪਕਰਨ ਜਿਹੜੇ ਨੇ ਨਾ ਬਹੁਤ ਹੀ ਵਧੀਆ ਨੇ ਅਤੇ ਮੈਂ ਜੇ ਅਸੀ ਬਾਹਰ ਜਾਣਾ ਹੋਵੇ ਅਤੇ ਅਤੇ ਅਸੀਂ ਮਤਲਬ ਇਹ ਫੋਨ ਦੀ ਵਰਤੋਂ ਵੀ ਇਹੀ ਕਰਦੇ ਹਾਂ ਅਤੇ ਜੇ ਫੋਨ ਵਗੈਰਾ ਨਾ ਹੋਣ ਅਤੇ ਅਸੀਂ ਕਿਸੇ ਦੇ ਨਾਲ ਗੱਲ ਵੀ ਨਹੀਂ ਕਰ ਸਕਦੇ ਹਨ ਅਤੇ ਮੈਂ ਇਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਪ੍ਰਭਾਵ ਪੈਂਦਾ ਆ ਕਿਉਂਕਿ ਅੱਜ ਕੱਲ੍ਹ ਨਵੀਂ ਟੈਕਨੋਲੋਜੀ ਜਿਹੜੀ ਹੈ ਬਹੁਤ ਹੀ ਵਧੀਆ ਆ ਕਿਉਂਕਿ ਅਸੀਂ ਹਰ ਇੱਕ ਦੇ ਨਾਲ ਬਾ ਜਿਹੜੇ ਸਾਡੇ ਰਿਸ਼ਤੇਦਾਰ ਬਾਹਰ ਵੀ ਗਏ ਹੋਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਵੀਡੀਓ ਕਾਲਿੰਗ ਵਗੈਰਾ ਕਰ ਸਕਦੇ ਹਾਂ ਅਤੇ ਸਾਡਾ ਇਹਦੇ ਨਾਲ ਸਾਰਾ ਦਿਨ ਜਿਹੜਾ ਉਹ ਪਾਸ ਹੋ ਜਾਂਦਾ ਆ ਜੇ ਉਪਕਰਨ ਨਾ ਹੁੰਦੇ ਤਾਂ ਅਸੀਂ ਤਾਂ ਸਾਰੀ ਦਿਹਾੜੀ ਮਾਯੂਸ ਹੀ ਹੋ ਜਾਣਾ ਸੀਗਾ ਅਤੇ ਸਾਡਾ ਦਿਨ ਵੀ ਪਾਸ ਨਹੀਂ ਸੀ ਹੋਣਾ ਇਹਦੇ ਨਾਲ ਅਸੀਂ ਜੇ ਅਸੀਂ ਬਾਹਰ ਜਾਣਾ ਹੋਵੇ ਫੋਨ ਨਾਲ ਕੇ ਜਾ ਕੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲ ਕਰ ਸਕਦੇ ਹਾਂ ਉਹਨਾਂ ਦਾ ਹਾਲ ਚਾਲ ਪੁੱਛ ਸਕਦੇ ਹਾਂ ਅਤੇ ਸਾਨੂੰ ਹੋਰ ਵੀ ਉਹਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਯੂਟੀਊਬ ਦੇ ਵਿੱਚੋਂ ਸਾਨੂੰ ਕਈ ਚੀਜ਼ਾਂ ਦੀ ਜਾਣਕਾਰੀ ਮਿਲਦੀ ਆ ਜਿਹੜੀ ਕਿ ਸਾਨੂੰ ਜਾਣਕਾਰੀ ਨਹੀਂ ਹੁੰਦੀ ਇਹ ਇੱਕ ਬਹੁਤ ਹੀ ਵਧੀਆ ਉਪ ਉਪਕਰਨ ਨੇ ਜਿਹੜੇ ਬਣਾਏ ਹੋਏ